ਮੈਂ ਗਾਇਕੀ ਦੇ ਪ੍ਰਦਰਸ਼ਨ ਯਾਂ ਰਿਕਾਰਡਿੰਗ ਦੀ ਤਿਆਰੀ ਮੈਂ ਕੋਈ ਬਹੁਤ ਜਿਆਦਾ ਨਹੀਂ ਕਰਦੀ ਮੈਂ ਤੇ ਮੇਰਾ ਕਿਉਂਕਿ ਇਹ ਬਚਪਨ ਦਾ ਸ਼ੌਂਕ ਹੈਗਾ ਵੇ ਗਾਇ ਗਾਣੇ ਬੋਲਣਾ ਗਾਇਕੀ ਦਾ ਮੇਰਾ ਬਚਪਨ ਦਾ ਸ਼ੌਂਕ ਹ ਇਸ ਵਾਸਤੇ ਮੈਂ ਤੇ ਹੁਣ ਇੰਨੀ ਉਮਰ ਹੋ ਗਈ ਹੈ ਰਸੋਈ ਚ ਰੋਟੀ ਪਕਾਂਦੇ ਪਕਾਂਦੇ ਵੀ ਅਸੀਂ ਇਸ ਚੀਜ਼ ਦੀ ਪ੍ਰੈਕਟਿਸ ਕਰ ਲੈਦੇ ਆਂ ਕਿਉਂਕਿ ਮੈਨੂੰ ਇਹ ਹੁੰਦਾ ਕਿ ਮੈਂ ਜੇ ਰੋਟੀ ਪਕਾਨੀ ਪਈ ਆ ਐਸੇ ਬਹਾਨੇ ਮੇਰਾ ਟਾਈਮ ਹੀ ਬੜਾ ਵਧੀਆ ਬੀਤ ਜਾਂਦਾ ਵੇ ਤੇ ਮੇਰੀ ਪ੍ਰੈਕਟਿਸ ਵੀ ਹੋ ਜਾਂਦੀ ਹ ਅੰਦਰ ਕੰਮ ਕਰਦੇ ਹੋਏ ਵੀ ਮੈਂ ਇਹ ਬੋਲ ਲੈਦੀ ਆਂ ਮੇਰਾ ਬੇਟਾ ਵੀ ਮੈਨੂੰ ਇਸ ਗੱਲ ਤੇ ਬੜਾ ਖੁਸ਼ ਹੁੰਦਾ ਵੇ ਕਿ ਮੰਮੀ ਕੁਝ ਨਾ ਕੁਝ ਭੇਟਾ ਵਗੈਰਾ ਬੋਲਦੇ ਰਹਿੰਦੇ ਨੇ ਜੇ ਉਹਨੇ ਵੈਸੇ ਆਪਣੇ ਘਰ ਚ ਇੱਕ ਸਾਡਾ ਕਮਰਾ ਬਣਾਇਆ ਹੋਇਆ ਵੇ ਜਿਹਦੇ ਵਿੱਚ ਉਹ ਰਿਕਾਰਡ ਕਰਦਾ ਰਹਿੰਦਾ ਆਪਣੇ ਗਾਣੇ ਕਿਉਂਕਿ ਉਹਨੂੰ ਗਾਣੇ ਦਾ ਬਹੁਤ ਸ਼ੌਂਕ ਹੈਗਾ ਵੈ ਉਹ ਮੈਨੂੰ ਵੀ ਬੁਲਾ ਕੇ ਕਈ ਵਰੀ ਕਹਿੰਦਾ ਕਿ ਮੰਮੀ ਐਥੇ ਕੋਈ ਗਾਣਾ ਆਉਦਾ ਕਿ ਮੰਮੀ ਇਹ ਰਿਕਾਰਡਿੰਗ ਤੁਸੀਂ ਇਹ ਗਾਣਾ ਰਿਕਾਰਡ ਕਰ ਦਿਓ ਤੇ ਤਾਂ ਮੈਂ ਉੱਥੇ ਜਾ ਕੇ ਕਰ ਲਿਆ ਨਹੀਂ ਤੇ ਮੇਰਾ ਜਿਆਦਾਤਰ ਐਹੀ ਹੁੰਦਾ ਕੀ ਮੈਂ ਰਸੋਈ ਚ ਆਪਣਾ ਕੰਮ ਕਰਦੇ ਕਰਦੇ ਹੀ ਬੋਲਦੀ ਰਹਿੰਨੀ ਆ ਉਹਦੇ ਨਾਲ ਹੀ ਬੜਾ ਵਧੀਆ ਹੋ ਜਾਂਦਾ ਵੈ ਸਾਰੇ ਪ੍ਰੈਕਟਿਸ ਹੋ ਜਾਂਦੀ ਹ ਤੇ ਫਿਰ ਕਿਸੇ ਦੇ ਘਰ ਕੀਰਤਨ ਵਗੈਰਾ ਹੁੰਦਾ ਹ ਤੇ ਉੱਥੇ ਜਾ ਕੇ ਆਪਾਂ ਭੇਟਾ ਬੋਲ ਲਈ ਦੀਆਂ ਨੇ ਉਹਦੇ ਨਾਲ ਇਹ ਸਾਡਾ ਬੜਾ ਵਧੀਆ ਹੈਗਾ ਵੈ ਪ੍ਰੈਕਟਿਸ ਕਰਨ ਦਾ ਤਰੀਕਾ ਧੰਨਵਾਦ ਜੀ